ਜ਼ਿੰਦਗੀ ਜਿਹੜੀ ਆ ਉਹ ਪੈਰ ਪੈਰ 'ਤੇ ਸਾਨੂੰ ਸਬਕ ਸਿਖਾਉਂਦੀ ਆ ਤੁਸੀਂ ਉਸ ਦੇ ਸਬਕਾਂ ਨੂੰ ਕਿੰਨਾਂ ਕੁ ਯਾਦ ਰੱਖਣਾ ਕਿੰਨਾ ਕੁ ਨਹੀਂ ਰੱਖਣਾ ਇਹ ਤੁਹਾਡੇ 'ਤੇ ਨਿਰਭਰ ਕਰਦਾ ਏ ਜੇ ਤੁਸੀਂ ਸਬਕਾਂ ਦੇ ਨਾਲ ਕੁਛ ਸਿੱਖਦੇ ਜਾਉਂਗੇ ਵਾਕੇ ਹੀ ਉਹਨਾਂ ਨੂੰ ਅਤੇ ਅਮਲ ਵੀ ਕਰੋਂਗੇ ਤਾਂ ਹੀ ਉਹਨਾਂ ਦਾ ਫਾਇਦਾ ਵੀ ਹੈ ਮੈਂ ਆਪਣੀ ਜ਼ਿੰਦਗੀ 'ਚ ਜਿਹੜੇ ਸਬਕ ਸਿੱਖੇ ਆ ਇੱਕ ਚੁੱਪ ਰਹਿਣਾ ਤਾਂ ਬੋਲਣਾ ਇਹ ਸਾਰਿਆਂ ਨੂੰ ਹੀ ਆਉਂਦਾ ਹੈ ਲੇਕਿਨ ਸਾਰਿਆਂ ਨੂੰ ਇਹ ਨਹੀਂ ਆਉਂਦਾ ਕਿ ਕਿਹੜੇ ਵੇਲੇ ਚੁੱਪ ਰਹਿਣਾ ਅਤੇ ਕਿਹੜੇ ਵੇਲੇ ਬੋਲਣਾ ਚੁੱਪ ਰਹਿਣਾ ਤੁਹਾਡੀ ਤਾਕਤ ਹੈ ਲੇਕਿਨ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਮਾਹੌਲ ਦੇਖ ਕੇ ਕਿਵੇਂ ਚੁੱਪ ਰਹਿਣਾ ਚਾਹੀਦਾ ਹੈ ਕਿਹੜੇ ਟਾਇਮ ਸਾਨੂੰ ਚੁੱਪ ਰਹਿਣਾ ਸਾਡੇ ਫਾਇਦੇ 'ਚ ਆ ਅਤੇ ਕਿਹੜੇ ਟਾਇਮ ਜਿੱਥੇ ਬੋਲਣਾ ਤੁਹਾਡਾ ਫਾਇਦੇ 'ਚ ਆ ਤੁਹਾਨੂੰ ਜੇ ਇਹ ਚੀਜ਼ ਸਮਝ ਆ ਗਈ ਤਾਂ ਤੁਸੀ ਜ਼ਿੰਦਗੀ ਦੀ ਬਹੁਤ ਵੱਡੀ ਲੜਾਈ ਜਿੱਤ ਜਾਂਦੇ ਹੋ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਜਦ ਬੜੇ ਬੋਲਦੇ ਆ ਤਾਂ ਸੁਣੋ ਪਹਿਲੇ ਅਗਲੇ ਦੀ ਗੱਲ ਨੂੰ ਚੰਗੀ ਤਰ੍ਹਾਂ ਸੁਣੋ ਚਾਹੇ ਕੋਈ ਗੁੱਸੇ 'ਚ ਹੀ ਆ ਓਹਦੀ ਗੱਲ ਨੂੰ ਸੁਣੋ ਸੁਣਦੇ ਰਹੋ ਸੁਣਦੇ ਰਹੋ ਸਾਰਾ ਕਨਕਲੂਜਨ ਜਦ ਤੁਸੀਂ ਚੁੱਪ ਰਹਿ ਕੇ ਸੁਣੋਗੇ ਤਾਂ ਤੁਹਾਨੂੰ ਮਿਲ ਜਾਣਾ ਫਿਰ ਤੁਸੀਂ ਸਾਰਾ ਕੁਝ ਸ਼ਾਂਤੀ ਨਾਲ ਸੋਚ ਕੇ ਅਗਲੇ ਨੂੰ ਜਵਾਬ ਦੇ ਸਕਦੇ ਆ ਅਤੇ ਉਹ ਜਵਾਬ ਢੁੱਕਵਾਂ ਹੁੰਦਾ ਹੈ ਜੇ ਤੁਸੀਂ ਪਹਿਲੇ ਰੌਲਾ ਪਾਉਣ ਲੱਗ ਗਏ ਅਗਲਾ ਵੀ ਉੱਚੀ ਉੱਚੀ ਬੋਲ ਰਿਹਾ ਤੁਸੀਂ ਵੀ ਉੱਚੀ ਉੱਚੀ ਬੋਲ ਰਹੇ ਹੋ ਤੁਸੀਂ ਜਿੱਤ ਨਹੀਂ ਸਕਦੇ ਤੁਸੀਂ ਸਿਰਫ ਬਹਿਸ ਕਰ ਸਕਦੇ ਆ ਤਾਂ ਜੇ ਜਿੱਤਣਾ ਆ ਅਤੇ ਪਹਿਲਾਂ ਚੁੱਪ ਰਹੋ ਫਿਰ ਸੋਚੋ ਸਮਝੋ ਅਤੇ ਬੋਲੋ